ਹਾਂਜੀ ਮੈਂ ਆਪਣੇ ਪਿੰਡ ਦੇ ਦੋਸਤਾਂ ਨਾਲ ਸਮੂਹ ਵਿੱਚ ਦੌੜਦਾ ਹਾਂ ਮੈਂ ਕਿਸੇ ਚੱਲ ਰਹੇ ਕਲੱਬ

ਸ਼ਾਮਲ ਤਾਂ ਨਹੀਂ ਹੋਇਆ ਪਰ ਮੇਰੀ ਇੱਕ ਦਿਲੀ ਇੱਛਾ ਹੈ ਕਿ ਮੈਂ ਇੱਕ ਚੱਲ ਰਹੇ ਵਧੀਆ ਕਲੱਬ ਵਿੱਚ ਸ਼ਾਮਲ ਹੋ ਕੇ ਦੌੜਨਾ ਚਾਹੁੰਦਾ ਹਾਂ